ਸਾਡੇ ਖੇਤਰ ਵਿੱਚ ਕ ਕਲਾ ਅਤੇ ਸ਼ਿਲਪਕਾਰੀ ਦੇ ਬਹੁਤ ਸਾਰੀਆਂ ਬੋਹਤਿਕ ਸੰਪਤੀਆਂ ਹਨ ਜਿੱਥੇ ਕਿ ਆਪਣੀ ਕਲਾ ਅਤੇ ਸ਼ਿਲਪਕਾਰੀ ਨੂੰ ਆਕਾਰ ਦਿੱਤਾ ਜਾਂਦਾ ਹੈ ਸਾਨੂੰ ਆਪਣੀ ਸ਼ਿਲਪਕਾਰੀ ਰਾਹੀਂ ਬਣਾਈਆਂ ਗਈਆਂ ਮੂਰਤੀਆਂ ਜਾਂ ਤਸਵੀਰਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਇਸ ਨੂੰ ਅਸੀਂ ਆਪਣੀ ਪਹਿਚਾਣ ਵਾਸਤੇ ਇੱਕ ਨਾਮ ਦਿੰਦੇ ਹਾਂ ਇਹ ਨਾਮ ਨੂੰ ਕੋਈ ਵਰਤ ਨਹੀਂ ਸਕਦਾ ਜੇਕਰ ਕੋਈ ਵਰਤਦਾ ਹੈ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜੇਕਰ ਅਸੀਂ ਹੋਰ ਕੋਈ ਵੀ ਕੰਮ ਕਰਦੇ ਹਾਂ ਤਾਂ ਉਹਨਾਂ ਦਾ ਕੋਈ ਕੋਪੀਰਾਈਟ ਨਹੀਂ ਕਰ ਸਕਦਾ ਇਹ ਹਰ ਇੱਕ ਦੀ ਆਪਣੀ ਮਿਹਨਤ ਹੁੰਦੀ ਹੈ ਸਰਕਾਰ ਵੱਲੋਂ ਵੀ ਸਖਤ ਹਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਕਿਸੇ ਦਾ ਨਾਮ ਵਰਤ ਨਹੀਂ ਸਕਦਾ ਇਹਨਾਂ ਕਾਪੀਰਾਈਟ ਰਾਹੀਂ ਵਾਲੇ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਕਾਨੂੰਨ ਰਾਹੀਂ ਸਜ਼ਾ ਦਿੱਤੀ ਜਾਂਦੀ ਹੈ ਅਤੇ ਜੁ ਜੁਰਮਾਨਾ ਵੀ ਪਾਇਆ ਜਾਂਦਾ ਹੈ